ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਜਿਹੜਾ ਭਾਰਤ ਹੈ ਉਹ ਭਿੰਨਤਾਵਾਂ ਵਾਲ਼ਾ ਦੇਸ਼ ਹੈ ਕਿਉਂਕਿ ਭਾਰਤ ਵਿੱਚ ਅਲੱਗ ਅਲੱਗ ਧਰਮਾਂ ਅਲੱਗ ਅਲੱਗ ਸੱਭਿਆਚਾਰਾਂ ਅਲੱਗ ਅਲੱਗ ਨਸਲਾਂ ਦੇ ਲੋਕ ਰਹਿੰਦੇ ਹਨ ਕਿਉਂਕਿ ਆਪਣਾ ਭਾਰਤ ਸਦੀਆਂ ਪਹਿਲਾਂ ਗੁਲਾਮ ਵੀ ਰਿਹਾ ਅਤੇ ਉੱਥੋਂ ਭਾਰਤ ਵਿੱਚ ਉਹ ਤੋਂ ਕਈ ਦੇਸ਼ਾਂ ਤੋਂ ਕਈ ਸੂਬਿਆਂ ਤੋਂ ਲੋਕ ਆ ਕੇ ਵਸੇ ਨੇ ਜਿੰਨ੍ਹਾਂ ਦਾ ਆਪਣਾ ਧਰਮ ਹੈ ਆਪਣੀ ਭਾਸ਼ਾ ਏ ਆਪਣਾ ਸਾਰਾ ਕੁਝ ਹੈ ਪਰ ਇਸਦੇ ਬਾਵਜੂਦ ਵੀ ਭਾਰਤ ਵਿੱਚ ਸਾਰੇ ਲੋਕ ਰਲ਼ ਮਿਲਕੇ ਰਹਿੰਦੇ ਹੈ ਜਿਵੇਂ ਕਿ ਭਾਰਤ ਵਿੱਚ ਜਿਹੜੇ ਪ੍ਰਮੁੱਖ ਧਰਮ ਹੈ ਉਹ ਚਾਰ ਹੈ ਹਿੰਦੂ ਮੁਸਲਿਮ ਈਸਾਈ ਅਤੇ ਸਿੱਖ ਹਿੰਦੂਆਂ ਦੇ ਕੁਝ ਆਪਣੇ ਰੀਤੀ ਰਿਵਾਜ਼ ਹੈ ਕਿਉਂਕਿ ਉਹ ਜ਼ਿਆਦਾਤਰ ਮੰਦਿਰਾਂ 'ਚ ਜਾ ਕੇ ਪੂਜਾ ਕਰਦੇ ਹਾਂ ਅਤੇ ਉਹਨਾਂ ਦੇ ਅਕੋਡਿੰਗ ਉਹਨਾਂ ਦੇ ਵਿੱਚ ਹਿੰਦੂ ਮੱਤ ਦੇ ਵਿੱਚ ਚੁਰਾਸੀ ਲੱਖ ਦੇਵੀ ਦੇਵਤੇ ਜਿਨ੍ਹਾਂ ਦੀ ਉਹ ਪੂਜਾ ਕਰਦੇ ਐਂ ਅਤੇ ਉਨ੍ਹਾਂ ਦੇ ਅਧਾਰਿਤ ਉਨ੍ਹਾਂ ਦੇ ਆਪਣੇ ਕੁਝ ਸੱਭਿਆਚਾਰ ਹੈ ਆਪਣੇ ਕੁਝ ਰੀਤੀ ਰਿਵਾਜ਼ ਹੈ ਜਿਵੇਂ ਵਿਆਹ ਨੂੰ ਲੈ ਕੇ ਉਹਨਾਂ ਦੇ ਰੀਤੀ ਰਿਵਾਜ਼ ਹੋਰਾਂ ਨਾਲੋਂ ਅਲੱਗ ਹੈ ਅਤੇ ਅਸੀਂ ਗੱਲ ਕਰਦੇ ਹੈ ਮੁਸਲਿਮ ਸਮਾਜ ਦੀ ਮੁਸਲਿਮ ਸਮਾਜ ਦੇ ਵਿੱਚ ਉਹਨਾਂ ਦੇ ਅਲੱਗ ਸੱਭਿਆਚਾਰ ਹੈ ਕਿਉਂਕਿ ਉਹ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਪੈਗੰਬਰ ਹੈ ਮੁਹੰਮਦ ਸਾਹਿਬ ਹੈ ਉਸ ਉਹਦੀ ਉਹ ਕਰਦੇ ਐਂ ਅਰਾਧਨਾ ਕਰਦੇ ਐਂ ਅਤੇ ਉਹਨਾਂ ਦੇ ਸੱਭਿਆਚਾਰ ਉਹਨਾਂ ਦੇ ਵਿਆਹ ਦੇ ਰਸਮਾਂ ਟੋਟਲੀ ਆਪਣੇ ਤੋਂ ਡਿੰਫਰੈਟ ਹੈ ਅਤੇ ਉਹਤੋਂ ਬਾਅਦ ਗੱਲ ਕਰਦੇ ਈਸਾਈ ਧਰਮ ਦੀ ਈਸਾਈ ਧਰਮ ਵੀ ਸਭ ਤੋਂ ਪੁਰਾਣਾ ਧਰਮ ਮੰਨਿਆ ਜਾਂਦਾ ਏ ਇਹਨਾਂ ਦੇ ਰੀਤੀ ਰਿਵਾਜ਼ ਇਨ੍ਹਾਂ ਦੇ ਸੱਭਿਆਚਾਰ ਵੀ ਅਲੱਗ ਹੈ ਅਤੇ ਸਿੱਖਾਂ ਦੇ ਵਿੱਚ ਦਸ ਗੁਰੂ ਮੰਨੇ ਜਾਂਦੇ ਹਨ ਜਿੰਨ੍ਹਾਂ ਦੇ ਅਕੋਡਿੰਗ ਇਹਨਾਂ ਦੇ ਅਲੱਗ ਅਲੱਗ ਸੱਭਿਆਚਾਰ ਹੈ ਰੀਤੀ ਰਿਵਾਜ਼ ਹੈ ਪਹਿਰਾਵੇ ਦਾ ਫ਼ਰਕ ਹੈ ਅਤੇ ਇਹਨਾਂ ਸਭ ਗੱਲਾਂ ਦੇ ਬਾਵਜੂਦ ਵੀ ਭਾਰਤ ਵਿੱਚ ਸਾਰੇ ਲੋਕ ਰਲ਼ ਮਿਲਕੇ ਰਹਿੰਦੇ ਹੈ ਅਤੇ ਇੱਕ ਦੂਜੇ ਦੇ ਸੱਭਿਆਚਾਰ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਐਂ ਇਸ ਕਰਕੇ ਜਿਹੜਾ ਭਾਰਤ ਹੈ ਉਹ ਹੋਰਨਾਂ ਕੰਟਰੀਆਂ ਦੇ ਨਾਲੋਂ ਇਹਨੂੰ ਅਲੱਗ ਨਜ਼ਰੀਏ ਨਾਲ਼ ਦੇਖਿਆ ਜਾਂਦਾ ਹੈ ਕਿਉਂਕਿ ਭਾਰਤ ਦੇ ਵਿੱਚ ਇੱਕ ਤਾਂ ਸੱਭਿਆਚਾਰ ਅਲੱਗ ਹੈ ਸਾਰਿਆਂ ਨਾਲੋਂ ਤੇ ਦੂਜਾ ਇਹਨਾਂ ਦਾ ਪਹਿਰਾਵਾ ਅਲੱਗ ਹੈ ਜਿਵੇਂ ਹੁਣ ਆਪਣੇ ਭਾਰਤ ਵਿੱਚ ਕਿਤੇ ਵੀ ਕੋਈ ਆਪਦਾ ਆ ਜਾਂਦੀ ਹੈ ਜਿਵੇਂ ਕਿ ਕੋਈ ਫਲੱਡ ਆ ਗਿਆ ਕਿਤੇ ਕੋਈ ਹੜ੍ਹ ਆਗੇ ਤਾਂ ਜਿਹੜੇ ਭਾਰਤ ਦੇ ਵਾਸੀ ਹੈ ਉਹ ਸਾਰੇ ਮਿਲਕੇ ਇੱਕ ਦੂਜੇ ਦੀ ਮੱਦਦ ਕਰਦੇ ਐਂ ਜਿਵੇਂ ਸਿੱਖਾਂ 'ਚ ਪ੍ਰਚਲਿਤ ਹੈ ਕਿ ਉਹ ਲੰਗਰ ਲਗਾ ਲੰਗਰ ਲਾਉਣੇ ਸ਼ੁਰੂ ਕਰ ਦਿੰਦੇ ਹੈ ਅਤੇ ਬਾਹਰਲੇ ਕੰਟਰੀਆਂ 'ਚ ਇੱਦਾਂ ਦਾ ਕੁਝ ਨਹੀਂ ਹੈਗਾ ਬਾਹਰਲੀ ਕੰਟਰੀਆਂ 'ਚ ਮਤਲਬ ਲੋਕ ਇੱਕ ਦੂਜੇ ਦੀ ਕਦਰ ਨਹੀਂ ਕਰਦੇ ਅਤੇ ਇਸ ਕਰਕੇ ਜਿਹੜਾ ਭਾਰਤ ਹੈ ਦੂਜੀਆਂ ਕੰਟਰੀਆਂ ਨਾਲੋਂ ਅਲੱਗ ਹੈ ਦੂਜੇ ਸੱਭਿਆਚਾਰਾਂ ਨਾਲੋਂ ਅਲੱਗ ਹੈ